ਪੰਛੀਆਂ ਦੇ ਨਾਲ ਮੇਰਾ ਬਚਪਨ ਤੋਂ ਹੀ ਬਹੁਤ ਹੀ ਡੂੰਘਾ ਰਿਸ਼ਤਾ ਹੈ ਮੈਂ ਪੰਛੀਆਂ ਨੂੰ ਦੇਖਣਾ ਅਤੇ ਉਹਨਾਂ ਦੇ ਨਾਲ ਨਾਲ ਦੌੜਨਾ ਬਹੁਤ ਪਸੰਦ ਕਰਦਾ ਹਾਂ ਮੈਂ ਇਹ ਚੀਜ਼ ਬਚਪਨ ਤੋਂ ਕਰਦਾ ਆ ਰਿਹਾ ਹਾਂ ਬਚਪਨ ਤੋਂ ਹੀ ਪੰਛੀਆਂ ਨੂੰ ਦੇਖਣ ਦੇ ਲਈ ਮੈਂ ਚਿੜੀਆ ਘਰ ਦੇ ਵਿੱਚ ਜਾਂਦਾ ਸੀ ਮੈਨੂੰ ਮੈਂ ਅੱਜ ਤੱਕ ਸਭ ਤੋਂ ਵਧੀਆ ਜੋ ਪੰਛੀ ਹੈ ਉਹ ਚਿੜੀਆਂ ਦੇ ਨੂੰ ਹੀ ਮੰਨਦਾ ਹਾਂ ਜੋ ਕਿ ਸਵੇਰੇ ਉੱਠ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਂਦੀ ਹੈ ਜੋ ਕਿ ਅੱਜ ਤਾਰੀਖ ਦੇ ਵਿੱਚ ਬਹੁਤ ਹੀ ਘੱਟ ਦੇਖੀਆਂ ਜਾ ਰਹੀਆਂ ਹਨ ਕਿਉਂਕਿ ਅੱਜ ਦੇ ਤਰੀਕ ਦੇ ਵਿੱਚ ਮੋਬਾਇਲ ਨੈਟਵਰਕਾਂ ਦੇ ਕਾਰਨ ਉਹਨਾਂ ਨੂੰ ਰੇਡੀਏਸ਼ਨ ਲੱਗਣ ਦੇ ਨਾਲ ਬਹੁਤ ਹੀ ਨੁਕਸਾਨ ਹੋਇਆ ਅਤੇ ਉਹਨਾਂ ਦੀ ਬਹੁਤ ਘੱਟ ਜਨਸੰਖਿਆ ਹੋ ਗਈ ਹੈ ਕਿਉਂਕਿ ਉਹ ਇਹ ਰੈਡੀਏਸ਼ਨਾਂ ਨੂੰ ਨਹੀਂ ਸਹਿ ਸਕਦੇ ਅਤੇ ਟਾਈਮ ਟੂ ਟਾਈਮ ਉਹਨਾਂ ਦੇ ਜਨਸੰਖਿਆ ਘਟਦੀ ਗਈ ਅਤੇ ਅੱਜ ਉਹ ਬਹੁਤ ਹੀ ਘੱਟ ਦੇਖੀਆਂ ਜਾ ਸਕਦੀਆਂ ਹਨ ਮੈਂ ਜਿਹੜਾ ਪੰਛੀ ਦੇਖਿਆ ਸੀ ਉਹ ਬਹੁਤ ਛੋਟਾ ਸੀ ਅਤੇ ਉਹ ਚਿੜੀ ਸੀ ਅਤੇ ਉਹ ਚਿੜੀ ਸੀ ਅਤੇ ਉਹ ਪੰਜ ਛੇ ਇੰਚ ਦੇ ਵਿੱਚ ਹੁੰਦੀ ਹੈ ਇਸ ਤਰ੍ਹਾਂ ਪੰਛੀਆਂ ਦੇ ਨਾਲ ਜੋ ਮੇਰਾ ਲਗਾਵ ਸੀ ਉਹ ਬਹੁਤ ਜ਼ਿਆਦਾ ਹੈ ਅਤੇ ਅੱਗੇ ਵੀ ਬਣਿਆ ਰਹੇਗਾ ਧੰਨਵਾਦ